ਸਰ ਮੇਰਾ ਨਾਮ ਭਾਰਤ ਭੂਸ਼ਨ ਪਿੰਡ ਮਿਰਜਾਪੁਰ ਦਾ ਰਹਿਣ ਵਾਲਾ ਜ਼ਿਲ੍ਹਾ ਪਠਾਨਕੋਟ ਆ ਸਾਡੇ ਖ਼ੇਤਰ ਵਿੱਚ ਤਿੰਨ ਚਾਰ ਭਾਸ਼ਾ ਬੋਲੀਆਂ ਜਾਂਦੀਆਂ ਜਿਹਨਾਂ ਵਿੱਚ ਇੱਕ ਪੰਜਾਬੀ ਡੋਗਰੀ ਹਿੰਦੀ ਇੰਗਲਿਸ਼ 'ਤੇ ਇਹਨਾਂ ਵਿੱਚ ਸਾਰਿਆਂ ਤੋਂ ਵਧੀਆ ਬੋਲਣ ਵਾਲੀ ਬੋਲੀ ਜਿਹੜੀ ਆ ਉਹ ਪੰਜਾਬੀ ਹੈ ਜਿਹੜੀ ਸਾਡੀ ਮਾਤਰ ਭਾਸ਼ਾ ਅਤੇ ਜੇ ਗੱਲ ਕਰੀਏ ਕਿ ਸਿੱਖਿਆ ਦੇ ਪੱਧਰ ਵਿੱਚ ਲੋਕ ਹੋਰ ਭਾਸ਼ਾ ਸਿੱਖਣਾ ਚਾਹੁੰਦੇ ਆ ਉਹ ਤਾਂ ਆਈਲੈਟਸ ਵਗੈਰਾ ਕਰਕੇ ਜਿੱਦਾਂ ਇੰਗਲਿਸ਼ ਵਗੈਰਾ ਸਿੱਖ ਕੇ ਕਨੇਡਾ ਕਨੂਡਾ ਜਾਂਦੇ ਆ ਬੰਦੇ ਅਤੇ ਇਸ ਲਈ ਸਾਡੇ ਲੋਕਲ ਤਾਂ ਪੰਜਾਬੀ ਹੀ ਬੋਲੀ ਜਾਂਦੀ ਆ ਮੇਰਾ ਕਹਿਣ ਦਾ ਇਹੋ ਹੀ ਉਦੇਸ਼ ਹੈ ਕਿ ਪੰਜਾਬੀ ਭਾਸ਼ਾ ਹੀ ਬੋਲੀ ਜਾਵੇ ਪੰਜਾਬੀ ਭਾਸ਼ਾ ਬੋਲਣ ਵਿੱਚ ਹੈ ਵੀ ਸੌਖੀ ਦੂਜਾ ਸਾਨੂੰ ਮਾਣ ਵੀ ਮਹਿਸੂਸ ਹੁੰਦਾ ਕਿ ਅਸੀਂ ਪੰਜਾਬੀ ਹਾਂ ਅਤੇ ਪੰਜਾਬੀ ਬੋਲੀ ਨੂੰ ਅੱਗੇ ਕਰੀਏ ਅਤੇ ਬਹੁਤ ਵਧੀਆ ਲੱਗਦਾ ਜਿਹੜੇ ਆਪਣੇ ਭੈਣ ਭਰਾ ਦੋਸਤ ਆਂਢੀ ਗੁਆਂਢੀ ਪੰਜਾਬੀ ਬੋਲਦੇ ਆ ਅਤੇ ਪੰਜਾਬੀ ਵਿੱਚ ਗੱਲਾਂ ਕਰਦੇ ਆ ਅਤੇ ਪੰਜਾਬੀ ਨੂੰ ਤਰਜੀਹ ਦਿੰਦੇ ਆ ਬਹੁਤ ਵਧੀਆ ਲੱਗਦਾ ਜੇ ਅਤੇ ਆਪਾਂ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਮਾਤਾ ਪਿਤਾ ਤੋਂ ਹੀ ਪੰਜਾਬੀ ਸਿੱਖਦੇ ਆਏ ਹਾਂ ਦਾਦੀ ਦਾਦਿਆਂ ਤੋਂ ਕਹਾਣੀਆਂ ਸੁਣਦੇ ਆਏ ਹਾਂ ਪੰਜਾਬੀ ਵਿੱਚ ਅਤੇ ਇਸ ਲਈ ਸਾਡਾ ਇਹੋ ਮੰਨਣਾ ਕਿ ਪੰਜਾਬੀ ਬਹੁਤ ਵਧੀਆ ਬੋਲੀ ਆ ਅਤੇ ਪੰਜਾਬੀ ਨੂੰ ਹੀ ਹਰ ਕੋਈ ਸਿੱਖੇ ਅਤੇ ਹਰ ਕੋਈ ਬੋਲੇ ਸਾਡੇ ਨਾਲ ਲੱਗਦੀ ਸਟੇਟ ਦੇ ਵਿੱਚ ਹਿੰਦੀ ਬੋਲੀ ਜਾਂਦੀ ਹੈ ਅਤੇ ਨਾਲ ਹਿਮਾਚਲ ਲੱਗਦਾ ਹਿਮਾਚਲ ਵਿੱਚ ਵੀ ਹਿੰਦੀ ਬੋਲੀ ਜਾਂਦੀ ਆ ਪਰ ਸਾਡੇ ਪੰਜਾਬ ਜਿੱਦਾਂ ਮਾਧੋਪੁਰ ਜਾਂ ਪਠਾਨਕੋਟ ਦੇ ਏਰੀਏ ਦੇ ਵਿੱਚ ਪੰਜਾਬੀ ਹਿੰਦੀ ਡੋਗਰੀ ਅਤੇ ਇੰਗਲਿਸ਼ ਤਿੰਨੇ ਭਾਸ਼ਾ ਬੋਲੀਆਂ ਜਾਂਦੀਆਂ ਧੰਨਵਾਦ ਜੀ